ਮੈਨੂੰ ਚਿੱਤਰਕਾਰੀ ਦੇ ਵਿੱਚ ਰੁਚੀ ਤਾਂ ਹੈ ਬਹੁਤ ਪਰ ਮੇਰਾ ਕੁਛ ਸਿੱਖਣ ਦਾ ਕੋਈ ਟਾਈਮ ਨਹੀਂ ਲੱਗਾ ਜਿਸ ਕਰਕੇ ਮੇਰਾ ਖਿਆਲ ਹੀ ਨਹੀਂ ਇੱਧਰ ਆਇਆ ਅਤੇ ਨਾ ਹੀ ਮੈਨੂੰ ਟਾਈਮ ਲੱਗਾ ਹੈਗਾ ਉਸ ਤਰ੍ਹਾਂ ਸਾਡੇ ਸ਼ਹਿਰ ਦੇ ਵਿੱਚ ਆਰਟ ਗੈਲਰੀ ਹੈ ਜਿਹਦੇ ਵਿੱਚ ਬੱਚਿਆਂ ਨੂੰ ਗਰਮੀ ਛੁੱਟੀਆਂ ਵਿੱਚ ਚਿੱਤਰਕਾਰੀ ਦਾ ਕੋਰਸ ਕਰਵਾਉਂਦੇ ਨੇ ਅਤੇ ਜਿਹੜੀ ਕਿ ਸ਼ਹਿਰ ਦੇ ਵਿੱਚ ਸਭ ਨਾਲੋਂ ਵੱਡੀ ਚਿੱਤਰਕਾਰੀ ਦੀ ਸੰਸਥਾ ਹੈ